ਇਸ ਸਮੇੇਂ ਮੈਂ ਹਾਊਸਵਾਈਫ ਹਾਂ ਅੱਜ ਤੋਂ ਦਸ ਕੁ ਸਾਲ ਪਹਿਲਾਂ ਮੈਂ ਸਕੂਲ ਵਿੱਚ ਅਧਿਆਪਕਾਂ ਦੇ ਤੌਰ 'ਤੇ ਸੇਵਾ ਕਰਦੀ ਸੀ ਮੈਨੇ ਸਾਢੇ ਤਿੰਨ ਕੁ ਸਾਲ ਅਧਿਆਪਕਾ ਵਜੋਂ ਸਕੂਲ ਦੇ ਬੱਚਿਆਂ ਨੂੰ ਪੜ੍ਹਾਇਆ ਸਿੱਖਿਆ ਦਾ ਗਿਆਨ ਦਿੱਤਾ ਫਿਰ ਮੇਰੀ ਬੇਟੀ ਦਾ ਜਨਮ ਹੋਇਆ ਉਹ ਘੱਟ ਬੋਲਦੀ ਸੀ ਉਸਨੂੰ ਕੁਛ ਪ੍ਰੋਬਲਮ ਸੀਗੀਆਂ ਅਤੇ ਇਸ ਲਈ ਮੈਨੇ ਨੌਕਰੀ ਛੱਡ ਦਿੱਤੀ ਮੈਂ ਸੋਚਿਆ ਸੀ ਕਿ ਦੁਬਾਰਾ ਜੋਬ ਕਰਾਂ ਅਧਿਆਪਕਾ ਵਜੋਂ ਪ੍ਰੰਤੂ ਮੇਰੇ ਬੇਟੇ ਦਾ ਜਨਮ ਹੋ ਗਿਆ ਅਤੇ ਮੈਂ ਆਪਣਾ ਫੈਸਲਾ ਬਦਲ ਲਿਆ ਹੁਣ ਮੈਂ ਇੱਕ ਹਾਊਸਵਾਈਫ ਹਾਂ ਅਤੇ ਹਾਊਸ ਵਾਈਫ ਦੇ ਤੌਰ 'ਤੇ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਹਾਂ ਅਤੇ ਆਪਣੇੇ ਘਰ ਵਾਲੇ ਦਾ ਵੀ ਪਾਲਣ ਪੋਸ਼ਣ ਕਰ ਰਹੀ ਹਾਂ ਪਰ ਮੈਂ ਹੁਣ ਬਹੁਤ ਦੁਖੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਨੌਕਰੀ ਛੱਡ ਦਿੱਤੀ ਹੈ ਕਿਉਂਕਿ ਮੇਰੇ ਨਾਲ ਦੀਆਂ ਮੇਰੀਆਂ ਅਸ ਅਧਿਆਪਕਾਵਾਂ ਦੀ ਤਰੱਕੀ ਹੋ ਗਈ ਹੈ ਉਹ ਵਧੀਆ ਕੰਮ ਕਾਰ ਕਰ ਰਹੀਆਂ ਹਨ ਪਰ ਮੈਂ ਆਪਣੇ ਬੱਚਿਆਂ ਨਾਲ ਫਿਰ ਵੀ ਕੁਛ ਹੱਦ ਤੱਕ ਖੁਸ਼ ਹਾਂ